ਮੇਰੇ ਇਲਾਕੇ ਵਿੱਚ ਲੋਕ ਤਰਨ ਤਾਰਨ ਸਾਹਿਬ ਸ਼੍ਰੀ ਦਰਬਾਰ ਸਾਹਿਬ ਜਾਂਦੇ ਹਨ ਉੱਥੇ ਬਹੁਤ ਭਾਰੀ ਮੱਸਿਆ ਲੱਗਦੀ ਹੈ ਅਤੇ ਲੋਕ ਦੂਰੋਂ ਦੂਰੋਂ ਮੱਸਿਆ ਨਹਾਉਣ ਆਉਂਦੇ ਹਨ ਦੂਸਰਾ ਧਾਰਮਿਕ ਸਥਾਨ ਬਾਬਾ ਬੀੜ ਬਾਬਾ ਬੁੱਢਾ ਜੀ ਉੱਥੇ ਵੀ ਬਹੁਤ ਲੋਕ ਜਾਂਦੇ ਹਨ ਅਤੇ ਪੁੱਤਰ ਦੀ ਦਾਤ ਲੈਣ ਵਾਸਤੇ ਅਤੇ ਕਈ ਲੋਕ ਜੰਡ ਪੀਰ ਜਿੱਥੇ ਪੀਰਾਂ ਦੀ ਸਮਾਧ ਹੈ ਉੱਥੇ ਵੀ ਮੱਥਾ ਟੇਕਣ ਜਾਂਦੇ ਹਨ ਹਰ ਇੱਕ ਸਥਾਨ ਦਾ ਆਪਣਾ ਆਪਣਾ ਮਹੱਤਵ ਹੈ